ਮੈਂ ਆਪਣੇ ਕੈਮਰੇ ਨਾਲ ਅਜਿਹੀਆਂ ਤਸਵੀਰਾਂ ਖਿੱਚਦਾ ਹਾਂ ਜਿਸ ਦੇ ਨਾਲ ਨਾਲਦਿਆਂ ਦੀ ਉੱਤੇ ਮਨ ਦੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਮੈਂ ਜਿਆਦਾਤਰ ਤਸਵੀਰਾਂ ਕੁਦਰਤ ਦੀ ਦੇਣ ਅਤੇ ਧਾਰਮਿਕ ਸਥਾਨਾਂ ਦੀਆਂ ਖਿੱਚੀਆਂ ਹਨ ਜਿਸ ਦੇ ਨਾਲ ਆਮ ਲੋਕਾਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਜ਼ਿਆਦਾਤਰ ਮੈਂ ਘੁੰਮਣ ਦਾ ਸ਼ੌਕੀਨ ਹਾਂ ਜਿੱਥੇ ਵੀ ਜਾਂਦਾ ਹਾਂ ਮੈਂ ਆਪਣਾ ਕੈਮਰਾ ਨਾਲ ਲੈ ਕੇ ਜਾਂਦਾ ਹਾਂ ਅਤੇ ਤਸਵੀਰਾਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲੈਂਦਾ ਹਾਂ ਅਤੇ ਮੇਰੀਆਂ ਮੇਰੇ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਲੋਕਾਂ ਦੇ ਮਨਾਂ 'ਤੇ ਬਹੁਤ ਡੂੰਘਾ ਪ੍ਰਭਾਵ ਪਾਉਂਦੀਆਂ ਹਨ ਜਿਸ ਦੇ ਕਾਰਨ ਮੈਨੂੰ ਬੈਸਟ ਜਿਸ ਦੇ ਕਾਰਨ ਮੈਨੂੰ ਵਧੀਆ ਫੋਟੋਗ੍ਰਾਫਰ ਵੀ ਕਹਿੰਦੇ ਹਨ